ਹੱਥ ਨਾਲ ਸਿਲਾਈ ਕੀਤੇ ਗਏ ਕੱਪੜੇ ਬੜੇ ਵਧੀਆ ਤੇ ਕਾਫੀ ਟਾਈਮ ਤੱਕ ਚੱਲਣ ਵਾਲੇ ਹੁੰਦੇ ਨੇ ਇਹਨਾਂ ਕੱਪੜਿਆਂ ਦੀ ਸਿਲਾਈ ਬੜੀ ਮਜਬੂਤ ਹੁੰਦੀ ਹੈ ਕਿਉਂਕੀ ਇਹ ਬਰੀਕ ਵਕੀਏ ਨਾਲ ਟਾਂਕੇ ਨਾਲ ਸਿਲਾਈ ਕੀਤੀ ਜਾਂਦੀ ਹੈ ਅਤੇ ਇਹ ਕੱਪੜੇ ਕਾਫੀ ਟਾਈਮ ਤੱਕ ਚਲਦੇ ਨੇ ਨਾਲੇ ਇਹ ਕੱਪੜੇ ਆਪਣੀ ਫਿਟਿੰਗ ਦੇ ਅਨੁਸਾਰ ਸਿਲਾਈ ਕੀਤੇ ਜਾਂਦੇ ਨੇ ਅਤੇ ਰੇਡੀਮੇਟ ਕੱਪੜੇ ਬਾਜ਼ਾਰ ਵਿੱਚੋਂ ਆਪਾਂ ਜਦ ਲੈ ਕੇ ਆਨੇ ਐ ਇਹਨਾਂ ਕੱਪੜਿਆਂ ਦੀ ਸਿਲਾਈ ਮੋਟੀ ਹੁੰਦੀ ਹੈ ਤੇ ਆਪਾਂ ਨੂੰ ਫਿਟਿੰਗ ਵੀ ਕਰਵਾਉਨੀ ਪੈਂਦੀ ਐ ਬਾਜ਼ਾਰ ਵਿੱਚੋਂ ਲਿਆਂਦੇ ਹੋਏ ਕੱਪੜੇ ਦੀ ਕਢਾਈ ਵੀ ਕਾਫੀ ਮੋਟੀ ਹੁੰਦੀ ਹੈ ਪਰ ਹੱਥ ਨਾਲ ਕੀਤੀ ਹੋਈ ਕਢਾਈ ਸਿਲਾਈ ਬੜੀ ਵਧੀਆ ਹੁੰਦੀ ਐ ਇਹ ਸਿਲਾਈ ਕਾਫੀ ਲੰਬੇ ਟਾਈਮ ਤੱਕ ਚਲਦੀ ਹੈ ਹੱਥ ਨਾਲ ਕੀਤੀ ਹੋਈ ਸਿਲਾਈ ਦੇ ਕੱਪੜੇ ਵਧੀਆ ਹੁੰਦੇ ਨੇ ਜਦ ਕੀ ਬਾਜ਼ਾਰ ਵਿੱਚੋਂ ਰੇਡੀਮੇਟ ਆਪਾਂ ਵੱਡੇ ਵੱਡੇ ਮੌਲਾਂ ਚੋਂ ਤੇ ਬਾਜ਼ਾਰ ਵਿੱਚੋਂ ਆਪਾਂ ਸ਼ੋਰੂਮਾਂ ਚ ਜਦ ਵੀ ਕੱਪੜੇ ਲੈਨੇ ਹੈ ਕੱਪੜੇ ਦੇਖਣ ਚ ਬਹੁਤ ਵਧੀਆ ਹੁੰਦੇ ਨੇ ਪਰ ਇਹਨਾਂ ਦੀ ਬਲ ਇਹਨਾਂ ਦੀ ਬਜਾਏ ਹੱਥ ਨਾਲ ਸਿਲਾਈ ਕੀਤੇ ਗਏ ਅਤੇ ਬੁਨਾਈ ਕੀਤੇ ਹੋਏ ਕੱਪੜੇ ਉਹ ਕਾਫੀ ਮਜਬੂਤ ਤੇ ਲੰਬੇ ਟਾਈਮ ਤੱਕ ਚੱਲਣ ਵਾਲੇ ਹੁੰਦੇ ਨੇ ਆਪਾਂ ਛੋਟੇ ਬੱਚਿਆਂ ਦੀ ਜੁਰਾਬਾਂ ਤੋਂ ਲੈ ਕੇ ਟੋਪੀ ਸਿਰ ਦੀ ਤੱਕ ਸਾਰਾ ਕੁਛ ਹੱਥ ਨਾਲ ਬੁਨਾਈ ਕਰ ਸਕਦੇ ਹਾਂ ਅਤੇ ਆਪਾਂ ਬੱਚਿਆਂ ਦੇ ਕੱਪੜੇ ਵੀ ਹੱਥ ਨਾਲ ਸਿਲਾਈ ਕਰ ਸਕਦੇ ਹੈਂ ਜਦ ਕੀ ਬਾਜ਼ਾਰ ਵਿੱਚੋਂ ਲਿਆਂਦੇ ਹੋਏ ਕੱਪੜੇ ਦੇ ਮੁਤਾਬਿਕ ਇਹ ਕੱਪੜੇ ਕਾਫੀ ਟਾਈਮ ਤੱਕ ਚੱਲਦੇ ਨੇ